ਪੁਰਾਣੇ ਗੀਤਾਂ ਅਤੇ ਅੱਜ ਦੇ ਗੀਤਾਂ ਵਿੱਚ ਮੁੱਖ ਫ਼ਰਕ ਇਹ ਹੈ ਕਿ ਪੁਰਾਣੇ ਗੀਤਾਂ ਦੇ ਬੋਲ਼ ਬਹੁਤ ਜ਼ਿਆਦਾ ਸਫਾਈ ਨਾਲ ਸਮਝ ਆ ਜਾਂਦੇ ਹਨ ਅਤੇ ਜਿਹੜੇ ਅੱਜ ਦੇ ਗੀਤ ਹੈ ਉਹ ਸਮਝ ਆਉਣ ਵਿੱਚ ਥੋੜ੍ਹਾ ਟਾਈਮ ਲੱਗ ਜਾਂਦਾ ਹੈ ਕਿਉਂਕਿ ਇੱਕ ਤਾਂ ਇਹਨਾਂ ਵਿੱਚ ਜਿਹੜਾ ਸੰਗੀਤ ਹੈ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਪੁਰਾਣੇ ਸਮੇਂ ਵਿੱਚ ਜੋ ਸੰਗੀਤ ਹੁੰਦਾ ਸੀ ਬਹੁਤ ਘੱਟ ਹੁੰਦਾ ਸੀ ਅਤੇ ਅੱਜ ਦੇ ਟਾਈਮ ਵਿੱਚ ਬਹੁਤ ਜ਼ਿਆਦਾ ਆਧੁਨਿਕ ਯੰਤਰ ਵਰਤੇ ਜਾਂਦੇ ਹਨ ਜਦ ਕਿ ਪੁਰਾਣੇ ਟਾਈਮ ਦੇ ਵਿੱਚ ਆਧੁਨਿਕ ਯੰਤਰ ਬਹੁਤ ਘੱਟ ਵਰਤੇ ਜਾਂਦੇ ਸੀ ਜਿਸ ਕਰਕੇ ਜਿਹੜੇ ਬੋਲ਼ ਹੈ ਉਹ ਪੂਰੀ ਤਰ੍ਹਾਂ ਨਾਲ ਸਮਝ ਆਉਂਦੇ ਸੀ ਪਰ ਅੱਜ ਕੱਲ੍ਹ ਬੋਲ਼ ਜ਼ਿਆਦਾ ਸਮਝ ਜ਼ਿਆਦਾਤਰ ਬੋਲ ਸਮਝ ਨਹੀਂ ਆਉਂਦੇ ਮੈਨੂੰ ਸਭ ਤੋਂ ਜ਼ਿਆਦਾ ਪੁਰਾਣੇ ਗਾਣੇ ਪੁਰਾਣੇ ਗੀਤ ਹੀ ਪਸੰਦ ਹਨ